ਅਖ਼ਬਾਰ ਏਜੰਸੀਆਂ ਔਨਲਾਈਨ ਪਲੇਟਫਾਰਮ ਨਾਲ ਕੁਝ ਇਸ ਤਰ੍ਹਾਂ ਜੁੜੀਆਂ ਰਹਿੰਦੀਆਂ ਹਨ ਜਿਵੇਂ ਕਿ ਹੁਣ ਅੱਜ ਕੱਲ੍ਹ ਜ਼ਿਆਦਾਤਰ ਯੂਟਿਊਬ ਇੰਸਟਾਗ੍ਰਾਮ ਸੋਸ਼ਲ ਮੀਡੀਆ ਲਗਾ ਲਓ ਕਿ ਸੋਸ਼ਲ ਮੀਡੀਆ ਦੇ ਵਿੱਚ ਸਾਨੂੰ ਅਪਡੇਟ ਸਾਰੇ ਮਿਨਟ ਦੀ ਮਿਲਦੀ ਰਹਿੰਦੀ ਹੈ ਮਿਨਟ ਬਾਏ ਮਿਨਟ ਸਾਨੂੰ ਉਸ ਚੀਜ਼ ਦੀ ਅਪਡੇਟ ਮਿਲਦੀ ਰਹਿੰਦੀ ਹੈ ਸਾਰੀਆਂ ਨਿਊਜ਼ ਸਾਰੀਆਂ ਚੈਨਲਜ ਸੋਸ਼ਲ ਮੀਡੀਆ ਨੂੰ ਹੀ ਫੋਲੋ ਕਰਕੇ ਆਪਣੀ ਅਗਲੇ ਦਿਨ ਦੀ ਨਿਊਜ਼ ਹੈਡਲਾਈਨਜ ਨੂੰ ਛਾਪਦੀਆਂ ਹਨ ਸੋਸ਼ਲ ਮੀਡੀਆ ਅੱਜ ਕੱਲ੍ਹ ਇੰਨਾ ਕੁ ਤੇਜ਼ੀ ਨਾਲ ਕੰਮ ਕਰ ਰਿਹਾ ਹੈ ਕਿ ਉਸ ਤੋਂ ਨਿਊਜ਼ ਪਹਿਲਾਂ ਸਾਨੂੰ ਜਿਵੇਂ ਕਿ ਨਿਊਜ਼ ਪੇਪਰ ਦਾ ਇੰਤਜ਼ਾਰ ਕਰਨਾ ਪੈਂਦਾ ਸੀ ਪਿਛਲੇ ਦਿਨ ਦੀ ਪਿਛ ਸਾਰੀ ਨਿਊਜ਼ ਦੇਖਣ ਦੇ ਲਈ ਸਾਨੂੰ ਨਿਊਜ਼ ਚੈਨਲਾਂ 'ਤੇ ਹੀ ਮਤਲਬ ਟੀ ਵੀ ਦੇ ਉੱਤੇ ਨਿਊਜ਼ ਚੈਨਲਾਂ ਨੂੰ ਸੁਣਨਾ ਪੈਂਦਾ ਸੀ ਪਰ ਅੱਜ ਕੱਲ੍ਹ ਕੀ ਹੈ ਅਖ਼ਬਾਰਾਂ ਏਜੰਸੀਆਂ ਵੀ ਸੋਸ਼ਲ ਮੀਡੀਆ ਨੂੰ ਹੀ ਫੋਲੋ ਕਰਦੀਆਂ ਹਨ ਉਹ ਵਲੋਗ ਦੇ ਜ਼ਰੀਏ ਅਤੇ ਸੋਸ਼ਲ ਮੀਡੀਆ ਦੀਆਂ ਨਿਊਜ਼ਾਂ ਦੇ ਜ਼ਰੀਏ ਸਾਨੂੰ ਕੀ ਕਰਨਾ ਪੈਂਦਾ ਹੈ ਸਾਰਾ ਹੀ ਸਾਰੇ ਹੀ ਹਿੰਟ ਦਿੱਤੇ ਜਾਂਦੇ ਹਨ ਕਿ ਸਾਰੇ ਹੀ ਨਿਊਜ਼ ਸੋਸ਼ਲ ਮੀਡੀਆ ਦੇ ਉੱਤੇ ਸਭ ਤੋਂ ਪਹਿਲਾਂ ਆਉਂਦੀ ਹੈ ਫਿਰ ਉਸ ਤੋਂ ਬਾਅਦ ਉਸ 'ਤੇ ਉਸ ਨੂੰ ਨਿਊਜ਼ ਚੈਨਲਾਂ ਵਾਲੇ ਅਤੇ ਨਿਊਜ਼ ਪੇਪਰਾਂ ਵਾਲੇ ਛਾਪਦੇ ਹਨ ਅਗਲੇ ਦਿਨ ਉਸ ਹੀ ਦਿਨ ਦਾ ਦੀ ਘਟਨਾ ਸਭ ਤੋਂ ਪਹਿਲਾਂ ਸੋਸ਼ਲ ਮੀਡੀਆ ਉੱਤੇ ਦਿਖਾਈ ਜਾਂਦੀ ਹੈ ਤਾਂ ਸੋਸ਼ਲ ਮੀਡੀਆ ਦੇ ਨਾਲ ਲੋਕ ਅੱਜ ਕੱਲ੍ਹ ਵੱਧ ਤੋਂ ਵੱਧ ਜੁੜੇ ਰਹਿੰਦੇ ਹਨ